ਮੈਂ ਅੰਸ਼ੁਲ ਅਤੇ ਮੈਂ ਪਠਾਨਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਤਾਂ ਅੱਜ ਮੈਂ ਗੱਲ ਕਰਨ ਜਾ ਰਿਹਾ ਕਿ ਟੈਕਨੋਲੋਜੀ ਨੇ ਪਰਿਵਾਰਿਕ ਜੀਵਨ ਅਤੇ ਜੀਵਨ ਸ਼ੈਲੀ ਨੂੰ ਕਿਵੇਂ ਰੋਕਿਆ ਪਰ ਜੇ ਇਸ ਦਾ ਸਹੀ ਜਵਾਬ ਮੇਰੇ ਹਿਸਾਬ ਨਾਲ ਤਾਂ ਇਹ ਹੋਵੇਗਾ ਕਿ ਟੈਕਨੋਲੋਜੀ ਨੇ ਇਸ ਨੂੰ ਨਹੀਂ ਰੋਕਿਆ ਇਹ ਅਸੀਂ ਬੰਦਿਆਂ ਨੇ ਇਸ ਨੂੰ ਖੁਦ ਰੋਕਿਆ ਕਿਉਂਕਿ ਟੈਕਨੋਲੋਜੀ ਦੇ ਫਾਇਦੇ ਤਾਂ ਬਹੁਤ ਨੇ ਪਰ ਜਿਵੇਂ ਅਸੀਂ ਜਾਣਦੇ ਹਾਂ ਕਿ ਜਿਸ ਚੀਜ਼ ਦੇ ਫਾਇਦੇ ਹੈਗੇ ਨੇ ਤਾਂ ਉਸ ਦਾ ਨੁਕਸਾਨ ਵੀ ਹੈਗਾ ਤਾਂ ਟੈਕਨੋਲੋਜੀ ਨੇ ਪਰਿਵਾਰਿਕ ਜੀਵਨ ਅਤੇ ਜੀਵਨ ਸ਼ੈਲੀ ਨੂੰ ਇੰਝ ਰੋਕਿਆ ਇਹ ਕਿਹਾ ਜਾਂਦਾ ਪਰ ਮੇਰੇ ਹਿਸਾਬ ਨਾਲ ਇਹ ਬੰਦਿਆਂ ਨੇ ਰੋਕਿਆ ਕਿਉਂਕਿ ਬੰਦਿਆ ਨੇ ਨਾ ਟੈਕਨੋਲਜੀ ਦਾ ਗਲਤ ਇਸਤੇਮਾਲ ਕਰ ਕੇ ਜਾਂ ਉਸ ਦੀ ਬਹੁਤ ਜ਼ਿਆਦਾ ਵਰਤੋਂ ਕਰ ਕੇ ਇਹ ਚੀਜ਼ ਕੀਤੀ ਹੈ ਕਿਉਂਕਿ ਜਿਵੇਂ ਅੱਜ ਕੱਲ੍ਹ ਅਸੀਂ ਵੇਖਦੇ ਹਾਂ ਕਿ ਅਸੀਂ ਕਿਸੇ ਦੇ ਘਰ ਜਾਂਦੇ ਹਾਂ ਤਾਂਤੇ ਉੱਥੇ ਦੀ ਉਹਨਾਂ ਦੇ ਵਿੱਚ ਜੋ ਛੋਟੇ ਛੋਟੇ ਬੱਚੇ ਨੇ ਤਾਂ ਉਹਨਾਂ ਦੇ ਪਰਿਵਾਰ ਮੈਂਬਰਾਂ ਨੇ ਉਹਨਾਂ ਨੂੰ ਵੀ ਫੋਨ ਦਿੱਤੇ ਹੋਏ ਨੇ ਤਾਂ ਉਹ ਪਹਿਲਾਂ ਕੀ ਹੁੰਦਾ ਸੀ ਕਿ ਬੱ ਜਿ ਜਿੱਦਾਂ ਅਸੀਂ ਕਿਸੇ ਦੇ ਘਰ ਜਾਂਦੇ ਸੀ ਤਾਂ ਬੱਚੇ ਸਾਡੇ ਵਿੱਚ ਬਹਿੰਦੇ ਸੀ ਅਤੇ ਗੱਲਾਂ ਕਰਦੇ ਸੀ ਆਪਣੀਆਂ ਗੱਲਾਂ ਸੁਣਾਉਂਦੇ ਸੀ ਅਤੇ ਅਸੀਂ ਉਹਨਾਂ ਨੂੰ ਸੁਣਾਉਂਦੇ ਸੀ ਹੱਸਦੇ ਖੇਡਦੇ ਸੀ ਅਤੇ ਹੋਰ ਵੀ ਬਹੁਤ ਕੁਝ ਕਰਦੇ ਸੀ ਪਰ ਅੱਜ ਕੱਲ੍ਹ ਕੀ ਹੁੰਦਾ ਅੱਜ ਕੱਲ੍ਹ ਜੀ ਅਸੀਂ ਕਿਸੇ ਦੇ ਘਰ ਜਾਂਦੇ ਹਾਂ ਤਾਂ ਉਹ ਬੱਚੇ ਫੋਨ ਲੈ ਕੇ ਲੱਗੇ ਰਹਿੰਦੇ ਨੇ ਉਹ ਫੋਨ 'ਤੇ ਹੀ ਵਿੱਚ ਖੋਏ ਰਹਿੰਦੇ ਨੇ ਜਿਵੇਂ ਕਿ ਕੁਝ ਆਨਲਾਈਨ ਯੂਟਿਊਬ ਚਲਾਉਂਦੇ ਰਹਿੰਦੇ ਨੇ ਜਾਂ ਫਿਰ ਹੋਰ ਵੀ ਬਹੁਤ ਕੁਛ ਫੋਨ ਗੇਮਾਂ ਖੇਡਦੇ ਰਹਿੰਦੇ ਨੇ ਜਿ ਅਤੇ ਜਿਸ ਦਾ ਬਹੁਤ ਨੁਕਸਾਨ ਹੈ ਜਿੱਦਾਂ ਗੇਮਾਂ ਦਾ ਤਾਂ ਫੋਨ ਦਾ ਤਾਂ ਬਹੁਤ ਨੁਕਸਾਨ ਹੈ ਜਿੱਦਾਂ ਗੇਮਾਂ ਖੇਡੋ ਜ਼ਿਆਦਾ ਤੋਂ ਜ਼ਿਆਦਾ ਤਾਂ ਉਹ ਬਹੁਤ ਹਾਨੀਕਾਰਕ ਹੈ ਅੱਖਾਂ 'ਤੇ ਉਹਨਾਂ 'ਤੇ ਅਤੇ ਇਸ ਕਰਕੇ ਮੇਰਾ ਹਿਸਾਬ ਨਾਲ ਤਾਂ ਇਹ ਟੈਕਨੋਲੋਜੀ ਦੀ ਗਲਤੀ ਨਹੀਂ ਹੈ ਜੇ ਅਸੀਂ ਟੈਕਨੋਲੋਜੀ ਨੂੰ ਇੱਕ ਸਹੀ ਢੰਗ ਨਾਲ ਇਸਤੇਮਾਲ ਕਰਾਂਗੇ ਤਾਂ ਉਹ ਸਾਨੂੰ ਫਾਇਦਾ ਜ਼ਰੂਰ ਦੇਵੇਗੀ ਅਤੇ ਇਹ ਗਲਤੀ ਸਾਡੀ ਖੁਦ ਦੀ ਹੈ ਕਿਉਂਕਿ ਜੇ ਇੱਕ ਵਾਰੀ ਬੱਚੇ ਨੇ ਜਿੱਦ ਕਰਤੀ ਕਿ ਮੈਨੂੰ ਫੋਨ ਚਾਹੀਦਾ ਤਾਂ ਉਸ ਦੇ ਮਾਂ ਬਾਪ ਉਸ ਨੂੰ ਪਹਿਲਾਂ ਤਾਂ ਮਨ੍ਹਾ ਕਰਨਗੇ ਲੇਕਿਨ ਵਾਰ ਵਾਰ ਜਿੱਦ ਕਰਨ 'ਤੇ ਉਹ ਦਿਲਾ ਹੀ ਦੇਣਗੇ ਅਤੇ ਇਸ ਕਰਕੇ ਉਹ ਉਹਨਾਂ ਦੀ ਗਲਤੀ ਹੈ ਅਤੇ ਜਿੱਦਾਂ ਹੁਣ ਇੱਕ ਬੱ ਬੱਚੇ ਨੇ ਲਿਆ ਫੋਨ ਤਾਂ ਉਸ ਤੋਂ ਬਾਅਦ ਉਹਦਾ ਦੋਸਤ ਉਸ ਵੱਲ ਵੇਖੇਗਾ ਅਤੇ ਉਸ ਬਿਲਕੁਲ ਸਹੀ ਸੇਮ ਮੰਗ ਆਪਣੇ ਘਰ ਜਾ ਕੇ ਕਰੇਗਾ ਤਾਂ ਫਿਰ ਉੱਥੇ ਵੀ ਇੱਦਾਂ ਹੀ ਚੱਲੇਗਾ ਤਾਂ ਅੱਜ ਕੱਲ੍ਹ ਤਾਂ ਅਸੀਂ ਇਹ ਵੀ ਵੇਖਦੇ ਹਾਂ ਕਿ ਜਿਵੇਂ ਕਿ ਆਈ ਪੀ ਐਲ ਵਗੈਰਾ ਜਾਂ ਕ੍ਰਿਕਟ ਵਗੈਰਾ ਚੱਲਦਾ ਤਾਂ ਕਈ ਛੋਟੇ ਛੋਟੇ ਬੱਚੇ ਜੋ ਮਤਲਬ ਸਕੂਲਾਂ ਵਿੱਚ ਪੜ੍ਹਦੇ ਨੇ ਉਹ ਇਹਨਾਂ ਚੱਕਰਾਂ ਵਿੱਚ ਪੈ ਜਾਂਦੇ ਨੇ ਤਾਂ ਆਨਲਾਈਨ ਸੱਟੇਬਾਜ਼ੀਆਂ ਦਾ ਸ਼ਿਕਾਰ ਹੋ ਜਾਂਦੇ ਨੇ ਜਿਸ ਦੀ ਉਹਨਾਂ ਨੂੰ ਆਦਤ ਲੱਗ ਜਾਂਦੀ ਹੈ ਅਤੇ ਉਹ ਇਹ ਗੱਲਾਂ ਫਿਰ ਘਰ ਵਾਲਿਆਂ ਤੋਂ ਲੁਕਾਉਂਦੇ ਨੇ ਤਾਂ ਮੇਨ ਮਕਸਦ ਮੇਰਾ ਕਹਿਣ ਦਾ ਇਹੀ ਹੈ ਕਿ ਜੇ ਟੈਕਨੋਲੋਜੀ ਨੂੰ ਅਸੀਂ ਸਹੀ ਤਰੀਕੇ ਨਾਲ ਇਸਤੇਮਾਲ ਕਰਾਂਗੇ ਜਾਂ ਉਸਦਾ ਘੱਟ ਇਸਤੇਮਾਲ ਕਰਾਂਗੇ ਨੋਰਮਲ ਤਾਂ ਉਹ ਸਾਡੇ ਲਈ ਬਹੁਤ ਬੈਨੀਫਿਟ ਦੇਵੇਗੀ ਬਹੁਤ ਸਹੀ ਲਾਭ ਦੇਵੇਗੀ ਸਾਨੂੰ ਪਰ ਜੇ ਅਸੀਂ ਉਸ ਨੂੰ ਜ਼ਿਆਦਾ ਇਸਤੇਮਾਲ ਕੀਤਾ ਤਾਂ ਉਹ ਸਾਡੇ ਲਈ ਬਹੁਤ ਹਾਨੀਕਾਰਕ ਹੈ ਅਤੇ ਫਿਰ ਫਿਰ ਉਹ ਸਾਡੇ ਜੀਵਨ ਅਤੇ ਜੀਵਨ ਸ਼ੈਲੀ ਨੂੰ ਰੋਕਦੀ ਹੈ ਤਾਂ ਇਸ ਕਰਕੇ ਸਾਨੂੰ ਇਹ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਧੰਨਵਾਦ